ਮੈਂ ਕੱਲ੍ਹ ਹੀ ਨਵਾਂ ਆਈ ਫ਼ੋਨ ਲਿਆ ਹੈ ਜੋ ਕਿ ਮੇਰੇ ਪਹਿਲਾਂ ਵਾਲੇ ਸਮਸੰਗ ਫ਼ੋਨ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਮੈਂ ਇਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਆਈ ਫ਼ੋਨ ਵਿੱਚ ਬਹੁਤ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਜੇ ਤੁਸੀਂ ਚਲਾਓਂਗੇ ਤਾਂ ਹੀ ਤੁਹਾਨੂੰ ਪਤਾ ਲੱਗਣਗੀਆਂ ਤਾਂ ਇੱਕ ਇਹ ਦਾ ਬਹੁਤ ਹੀ ਵਧੀਆ ਜਿਹੜੀ ਕੁਆਲਿਟੀ ਆਪਾਂ ਕਹਿ ਸਕਦੇ ਹਾਂ ਉਹ ਇਹ ਹੈ ਕਿ ਇਹਦੇ ਵਿੱਚ ਓ ਐੱਲ ਈ ਡੀ ਸਕਰੀਨ ਹੈ ਜਿਹੜੀ ਕਿ ਆਪਣੀਆਂ ਅੱਖਾਂ ਦੀ ਰੋਸ਼ਨੀ ਨੂੰ ਅਫੈਕਟ ਨਹੀਂ ਕਰਦੀ ਇਸ ਲਈ ਇਹ ਸਭ ਤੋਂ ਵਧੀਆ ਇਹਦਾ ਮੈਨੂੰ ਪੁਆਇੰਟ ਲੱਗਿਆ ਆਈ ਫ਼ੋਨ ਜਿਸ ਕਰਕੇ ਤੁਹਾਨੂੰ ਲੈਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਕਾਲ ਰਿਕਾਡਿੰਗ ਨਹੀਂ ਕਰ ਸਕਦੇ ਇਹ ਵੀ ਇਹਦੀ ਬਹੁਤ ਹੀ ਵਧੀਆ ਗੱਲ ਹੈ ਕਿ ਆਪਾਂ ਕਿਸੇ ਦੀ ਵੀ ਗੱਲ ਰਿਕੋਡ ਨਹੀਂ ਕਰ ਸਕਦੇ ਉਹ ਵੀ ਇੱਕ ਇਹਦੇ ਹਰ ਇੱਕ ਲਈ ਬਹੁਤ ਹੀ ਵਧੀਆ ਪ੍ਰਾਈਵੇਸੀ ਦਾ ਕੰਮ ਕਰਦੀ ਹੈ ਇਸ ਲਈ ਮੈਂ ਇਹੀ ਰਾਇ ਦੇਣਾ ਚਾਹੁੰਦਾ ਹਾਂ ਕਿ ਸਾਰੇ ਆਈ ਫ਼ੋਨ ਹੀ ਖਰੀਦਣ